ਪੰਜ ਮਈ ਉੱਨੀ ਸੌ ਅਠੱਤਰ ਅੱਠ ਜਨਵਰੀ ਦੋ ਹਜ਼ਾਰ ਸੱਤ ਸਤਾਰਾਂ ਜੂਨ ਦੋ ਹਜ਼ਾਰ ਬਾਈ ਨਵੰਬਰ ਉੱਨੀ ਸੌ ਚੁਹੱਤਰ ਪੰਦਰਾਂ ਸਪਤੰਬਰ ਉੱਨੀ ਸੌ ਤੇਹੱਤਰ